ਪੰਜਾਬੀ ਭਾਸ਼ਾ ਹੋਰ ਭਾਸ਼ਾਵਾਂ ਸੰਸਕ੍ਰਿਤ ਅਤੇ ਅੰਗਰੇਜ਼ੀ ਦੁਆਰਾ ਪ੍ਰਭਾਵਿਤ ਤਾਂ ਹੋਈ ਹੈ ਉਹ ਇਸ ਤਰ੍ਹਾਂ ਹੋਈ ਹੈ ਜਿਵੇਂ ਕਿ ਪੰਜਾਬੀ ਭਾਸ਼ਾ ਪੰਜਾਬੀ ਸ਼ਬਦਾਂ ਵਿੱਚ ਜਿਵੇਂ ਕਿ ਕਿਸੇ ਆਪਣਾ ਅਦਾਰੇ 'ਚ ਜਾਂਦੇ ਜੀ ਆਪਾਂ ਤਾਂ ਉੱਥੇ ਕਈ ਵਾਰ ਆਪਾਂ ਨੂੰ ਅੰਗਰੇਜ਼ੀ ਜਾਂ ਸੰਸਕ੍ਰਿਤ ਵਿੱਚ ਬ ਜਿਵੇਂ ਬੈਂਕ 'ਚ ਹੋ ਗਿਆ ਬਾਊਚਰ ਬੋਰਡ ਵਗੈਰਾ ਹੋ ਗਏ ਉੱਥੇ ਪੰਜਾਬੀ ਨਹੀਂ ਹੁੰਦੀ ਤਾਂ ਕਰਕੇ ਅੱਜ ਕੱਲ੍ਹ ਸਨ ਹਰੇਕ ਬੰਦਾ ਚਾਹੁੰਦਾ ਕਿ ਸਾਨੂੰ ਜਿੱਥੇ ਜਿ ਜਿਹੜੀ ਭਾਸ਼ਾ ਦੀ ਲੋੜ ਹੈ ਉਹ ਸਿੱਖੀ ਜਾਵੇ ਜਿਵੇਂ ਕਿ ਹਰੇਕ ਤ ਤਕਰੀਬਨ ਸਰਕਾਰੀ ਜਾਂ ਪ੍ਰਾਈਵੇਟ ਅਦਾਰਿਆਂ ਵਿੱਚ ਇੰਗਲਿਸ਼ 'ਚ ਹੀ ਜ਼ਿਆਦਾ ਕੰਮ ਕੀਤਾ ਜਾਂਦਾ ਹੈ ਤਾਂ ਹਰੇਕ ਵਰਗ ਪੰਜਾਬੀ ਨੂੰ ਫਿਰ ਉਸ ਤੋਂ ਉਸ ਸਮੇਂ ਪੰਜਾਬੀ ਨੂੰ ਛੱਡ ਕੇ ਇ ਅੰਗਰੇਜ਼ੀ ਅੰਗਰੇਜ਼ੀ ਭਾਸ਼ਾ ਦੀ ਵਰਤੋਂ ਕਰਦੇ ਅਤੇ ਬੋਲ ਚਾਲ 'ਚ ਵੀ ਅੰਗਰੇਜ਼ੀ ਵਰਤੀ ਜਾਂਦੀ ਹੈ ਜਾਂ ਕਿਤੇ ਜ਼ਰੂਰੀ ਹੁੰਦਾ ਹੈ ਕਿ ਸੰਸਕ੍ਰਿਤ 'ਚ ਹੀ ਗੱਲਬਾਤ ਕੀਤੀ ਜਾਵੇ ਜਾਂ ਇ ਅੰਗਰੇਜ਼ੀ 'ਚ ਹੀ ਗੱਲਬਾਤ ਕੀਤੀ ਜਾਵੇ ਉੱਥੇ ਫਿਰ ਪੰਜਾਬੀ ਭਾਸ਼ਾ ਨੂੰ ਪਿੱਛੇ ਰੱਖਿਆ ਜਾਂਦਾ ਪੰਜਾਬੀ ਭਾਸ਼ਾ ਦੀ ਵਰਤੋਂ ਨਹੀਂ ਹੁੰਦੀ ਜਾਂ ਇ ਇਹੀ ਕਾਰਨ ਹੈ ਮੇਨ ਤਾਂ ਵੀ ਪੰਜਾਬੀ ਭਾਸ਼ਾ ਇਹਨਾਂ ਤੋਂ ਜ਼ਿਆਦਾ ਪ੍ਰਭਾਵਿਤ ਹੋ ਰਹੀ ਹੈ ਸਰਕਾਰ ਨੂੰ ਇਹ ਚਾਹੀਦਾ ਹੈ ਕਿ ਆਪਣਾ ਪੰਜਾਬੀ ਭਾਸ਼ਾ ਨੂੰ ਪ੍ਰਫੁੱਲਿਤ ਕਰਨ ਲਈ ਇਹ ਪੰਜਾਬੀ ਭਾਸ਼ਾ ਨੂੰ ਵੀ ਇਹਨਾਂ ਭਾਸ਼ਾਵਾਂ ਨਾਲ ਐਡ ਕੀਤਾ ਜਾਵੇ ਤਾਂ ਜੋ ਪੰਜਾਬੀ ਭਾਸ਼ਾ ਦੀ ਅਹਿਮੀਅਤ ਵੀ ਬਰਾਬਰ ਕੀਤੀ ਜਾਵੇ ਸਕੂਲਾਂ ਕਾਲਜਾਂ ਵਿਖੇ ਸਕੂਲਾਂ ਕਾਲਜਾਂ ਵਿਖੇ ਵੀ ਪੰਜਾਬੀ ਭਾਸ਼ਾ ਬ ਸਹੀ ਤਰੀਕੇ ਨਾਲ ਸਿਖਾਉਣੀ ਚਾਹੀਦੀ ਹੈ ਤਾਂ ਜੋ ਬੱਚਿਆਂ ਨੂੰ ਅੱਗੇ ਜਾ ਕੇ ਕੋਈ ਦਿੱਕਤ ਨਾ ਆਵੇ ਪੰਜਾ ਅੰਗਰੇਜ਼ੀ ਜਿਵੇਂ ਜ ਹਰੇਕ ਅਦਾਰਿਆਂ ਵਿਚ ਜ਼ਰੂਰੀ ਹੁੰਦੀ ਹੈ ਅਤੇ ਬ ਬੋਲਚਾਲ ਜੋ ਠੀਕ ਹੈ ਉਹ ਵੀ ਵਰਤਣੀ ਚਾਹੀਦੀ ਹੈ ਪਰ ਪੰਜਾਬੀ ਭਾਸ਼ਾ ਨੂੰ ਵੀ ਨਾਲ ਰੱਖਣਾ ਹੁਣ ਪੰਜਾਬ 'ਚ ਪੰਜਾਬੀ ਹੀ ਬੋਲੀ ਜਾਣੀ ਚਾਹੀਦੀ ਹੈ